ਸਰਕਾਰ ਦਾ ਕੰਮ ਹੈਗਾ ਵਾ ਕਿ ਉਹ ਕਾਰੀਗਰਾਂ ਵਾਸਤੇ ਕੀ ਹੈਗੇ ਆ ਕਰਜ਼ੇ ਜਿਹੜੇ ਹੈਗੇ ਉਹ ਪ੍ਰੋਵਾਈਡ ਕਰੇ ਕਰਜ਼ੇ ਪ੍ਰੋਵਾਈਡ ਕਰੇ ਘੱਟ ਵਿਆਜ਼ ਦਰ 'ਤੇ ਕਿ ਤਾਂ ਜੋ ਜਿਹੜੇ ਹੈਗੇ ਆ ਕਾਰੀਗਰ ਹੈਗੇ ਆ ਉਹ ਆਪਣਾ ਕੰਮ ਕੀ ਆ ਸ਼ੁਰੂ ਕਰ ਸਕਣ ਅਤੇ ਕਰਜ਼ਾ ਲੈ ਕੇ ਅਤੇ ਉਹਨੂੰ ਜਲਦੀ ਹੀ ਕੀ ਆ ਪੂਰਾ ਵੀ ਕਰ ਸਕਣ ਉਤਾਰ ਸਕਣ ਆਪਣਾ ਕਾਰੋਬਾਰ ਕੀ ਆ ਅੱਗੇ ਵਧਾਵਣ ਜਿਵੇਂ ਕਹਿ ਸਕਦੇ ਹੈਗੇ ਹਾਂ ਆਪਣੀ ਕਲਾਵਾਂ ਵਿਖਾਵਣ ਜਿਵੇਂ ਮਿੱਟੀ ਦੇ ਘੜੇ ਵਗੈਰਾ ਜਿਵੇਂ ਬਣਾਉਂਦੇ ਹੈਗੇ ਆ ਤਾਂ ਆਪਣੀ ਕੀ ਆ ਸ਼ੌਪ ਵਗੈਰਾ ਦੁਕਾਨ ਵਗੈਰਾ ਉਹਨਾਂ ਨੇ ਖੋਲ੍ਹ ਲੈਣੀ ਹੈਗੀ ਹੈ ਅਤੇ ਉਹ ਕਰਜ਼ੇ ਲਵੇ ਜੇ ਸਰਕਾਰ ਉਹਨਾਂ ਨੂੰ ਕਰਜ਼ਾ ਦਿੰਦੀ ਹੈਗੀ ਏ ਘੱਟ ਵਿਆਜ 'ਤੇ ਤਾਂ ਉਹਦੇ ਨਾਲ਼ ਕੀ ਹੋਵੇਗਾ ਦੇਸ਼ ਦੇ ਵਿੱਚ ਕੀ ਆ ਤਰੱਕੀ ਹੋਣੀ ਸ਼ੁਰੂ ਹੋ ਜੂਗੀ